ਸਤਿ ਸ਼੍ਰੀ ਅਕਾਲ ਅਮਨ ਭਾਅ ਜੀ ਮੈਂ ਤੁਹਾਡਾ ਕਸਟਮਰ ਬੋਲ ਰਿਹਾ ਫਲਿੱਪਕਾਟ ਤੋਂ ਮੈਂ ਸਰ ਤੁਹਾਡੇ ਕੋਲੋਂ ਚੀਜ਼ਾਂ ਮੰਗਵਾਉਂਦਾ ਰਹਿੰਦਾ ਤੁਸੀਂ ਮੈਨੂੰ ਡਲੀਵਰ ਕਰਕੇ ਗਏ ਸੀ ਲਾਸਟ ਟਾਈਮ ਘੜੀ ਬਹੁਤ ਸੋਹਣੀ ਸ ਪੈਕਿੰਗ ਸੀ ਉਹਦੀ ਅਤੇ ਬਹੁਤ ਵਧੀਆ ਉਹ ਚਲਦੀ ਵੀ ਪਈ ਹੈ ਇਸ ਵਾਰੀ ਜਿਹੜੀ ਭਾਅ ਜੀ ਮੈਂ ਚੀਜ਼ ਮੰਗਵਾਈ ਸੀ ਉਹ ਸੀਗਾ ਪਾਵਰ ਬੈਂਕ ਅਤੇ ਭਾਅ ਜੀ ਮੈਂ ਫੋਨ ਦੇ ਚਾਰਜ ਕਰਨ ਲਈ ਪਾਵਰ ਬੈਂਕ ਮੰਗਵਾਇਆ ਸੀ ਬਟ ਜਿਹੜੇ ਭਾਅ ਜੀ ਮੈਨੂੰ ਦੇ ਕੇ ਗਏ ਨੇ ਉਹ ਪੈਕਿੰਗ ਵੀ ਥੋੜ੍ਹੀ ਜਿਹੀ ਲੂਜ਼ ਸੀਗੀ ਜਦੋਂ ਮੈਂ ਉਹਨਾਂ ਨੂੰ ਪੇਮੈਂਟ ਕਰਤੀ ਅਤੇ ਮੈਂ ਅੰਦਰ ਜਾ ਕੇ ਉਹਨੂੰ ਖੋਲਿਆ ਅਤੇ ਉਹ ਥੋੜ੍ਹਾ ਜਿਹਾ ਸਾਈਡ ਤੋਂ ਕਰੈਕ ਵੀ ਸੀਗਾ ਅਤੇ ਮੈਨੂੰ ਇੰਝ ਲੱਗ ਰਿਹਾ ਕੇ ਜਿਵੇਂ ਉਹ ਥੋੜ੍ਹਾ ਜਿਹਾ ਡਿੱਗਿਆ ਹੋਇਆ ਵਾ ਅਤੇ ਭਾਅ ਜੀ ਪਹਿਲਾ ਪ੍ਰੋਡਕਟ ਐਡਾ ਵਧੀਆ ਅਤੇ ਦੂਸਰੇ ਪ੍ਰੋਡਕਟ ਦਾ ਭਾਅ ਜੀ ਬਿਲਕੁਲ ਹੀ ਇੱਦਾਂ ਕੋਈ ਕੇਅਰ ਨਹੀਂ ਕੀਤੀ ਗਈ ਅਤੇ ਉਹ ਵੀ ਬਸ ਫਟਾਫਟ ਮੈਨੂੰ ਪਕੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਵੀ ਫਟਾਫਟ ਮੈਂ ਪੈਸੇ ਪਕੜਾਂ ਔਰ ਮੈਂ ਇਥੋ ਜਾਵਾਂ ਅਤੇ ਭਾਅ ਜੀ ਪਲੀਜ਼ ਉਹ ਮੈਂ ਆਪਣਾ ਪਾਵਰ ਬੈਂਕ ਯੂਜ਼ ਨਹੀਂ ਕਰ ਸਕਦਾ ਕਿਉਂਕਿ ਉਹਦੀ ਉਹ ਹੈ ਹੀ ਨਹੀਂ ਕੈਪੇਬਿਲਿਟੀ ਨਹੀਂ ਹੈਗੀ ਕਿ ਵੀ ਅਸੀਂ ਉਹਨੂੰ ਯੂਜ਼ ਕਰ ਲਈਏ ਅਤੇ ਮੈਂ ਇਹਨੂੰ ਐਕਸਚੇਂਜ ਕਰਵਾਉਣਾ ਚਾਹੁੰਦਾ ਅਤੇ ਪਲੀਜ਼ ਮੇਰੀ ਇਸ ਜਿਹੜੀ ਹੈਗੀ ਇਹ ਗੱਲ ਇਹਨੂੰ ਚੇਂਜ ਕੀਤਾ ਜਾਵੇ ਅਤੇ ਮੈਨੂੰ ਇਹ ਰੀਪਲੇਸ ਕੀਤਾ ਜਾਵੇ